ਭਾਰਤ ਵਿੱਚ ਮੈਨੂੰ ਸਭ ਤੋਂ ਜ਼ਿਆਦਾ ਚੰਗਾ ਲੱਗਦਾ ਰਾਜਸਥਾਨ ਬਹੁਤ ਵਧੀਆ ਹੈ ਬਹੁਤ ਬੜਾ ਹੈ ਤੁਹਾਨੂੰ ਉੱਥੇ ਹਰਿਆਲੀ ਵੀ ਮਿਲ ਜਾਣੀ ਆ ਪਹਾੜ ਵੀ ਮਿਲ ਜਾਣੇ ਆ ਇੱਕ ਉਨ੍ਹਾਂ ਦਾ ਮਾਊਂਟ ਏਬੀ ਏਰੀਆ ਜਿਹੜਾ ਹੈਗਾ ਉਹ ਕਾਫੀ ਅੱਛਾ ਹਿਲ ਸਟੇਸ਼ਨ ਦੀ ਤਰ੍ਹਾਂ ਹੈ ਰਾਜਸਥਾਨ ਕੋਟਾ ਦੇ ਵਿੱਚ ਚਲੇ ਜਾਈਏ ਤਾਂ ਕਾਫੀ ਪ੍ਰਫੁੱਲਿਤ ਏਰੀਆ ਹੈ ਉੱਥੇ ਡੈਮ ਵੀ ਹੈਗਾ ਚੰਬਲ ਨਦੀ ਦੇ ਉੱਤੇ ਅਤੇ ਜੇ ਤੁਸੀਂ ਰੇਗਿਸਤਾਨ ਪਿਓਰ ਦੇਖਣਾ ਤੁਸੀਂ ਜੈਸਲਮੇਰ ਬੀਕਾਨੇਰ ਵਾਲੇ ਪਾਸੇ ਚਲੇ ਜਾਂਦੇ ਹਾਂ ਕਿਲ੍ਹੇ ਬਹੁਤ ਬੜੇ ਬੜੇ ਹੈ ਪੂਰੇ ਸਟੇਟ ਦੇ ਵਿੱਚ ਬਹੁਤ ਜ਼ਿਆਦਾ ਬੜੇ ਬੜੇ ਕਿਲ੍ਹੇ ਆ ਬਹੁਤ ਅੱਛੀ ਚੀਜ਼ਾਂ ਦੇਖਣ ਲਈ ਆ ਵਿਰਸਾ ਬਹੁਤ ਅਮੀਰ ਆ ਉਹਨਾਂ ਦਾ ਪੁਰਾਣਾ ਜੋ ਦੇਖਣ ਵਾਸਤੇ ਹੈਗਾ ਹੈ ਤੁਸੀਂ ਮੇਰੇ ਹਿਸਾਬ ਦੇ ਨਾਲ ਤੁਸੀਂ ਸ਼ਾਇਦ ਇੱਕ ਮਹੀਨੇ ਦੇ ਵਿੱਚ ਪੂਰਾ ਰਾਜਸਥਾਨ ਨਹੀਂ ਘੁੰਮ ਸਕਦੇ ਹੈਗੇ ਫਿਰ ਵੀ ਤੁਹਾਡਾ ਕੁਝ ਨਾ ਕੁਝ ਉਹਦੇ 'ਚ ਰਹਿ ਜੇਗਾ ਇਹੀ ਚੀਜ਼ ਉਹਦੀ ਖਾਸੀਅਤ ਹੈ ਜਿਹਦੇ ਕਰਕੇ ਉਹ ਬਹੁਤ ਵਧੀਆ ਲੱਗਦਾ ਹੈ